ਸਤਿ ਸ੍ਰੀ ਅਕਾਲ ਮੈਂ ਅੰਸ਼ ਮਹਾਜਨ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਅਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਮੈਂ ਪਿੰਡ ਵਿੱਚ ਮਹੀਨੇ ਦੇ ਆਖਰ ਵਿੱਚ ਚੱਕਰ ਜ਼ਰੂਰ ਮਾਰਦਾ ਹਾਂ ਕਿਉਂਕਿ ਸ਼ਹਿਰ ਦੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਹੀ ਦੌੜ ਭੱਜ ਵਾਲੀ ਹੈ ਅਤੇ ਰੌਲੇ ਰੱਪੇ ਵਾਲੀ ਹੈ ਉੱਥੇ ਹੀ ਦੂਜੇ ਪਾਸੇ ਪਿੰਡ ਵਿੱਚ ਬਹੁਤ ਹੀ ਸ਼ਾਂਤੀ ਹੁੰਦੀ ਹੈ ਅਤੇ ਮੈਂ ਪਿੰਡ ਵਿੱਚ ਆਪਣੇ ਦਾਦਾ ਦਾਦੀ ਅਤੇ ਆਪਣੇ ਚਾਚਾ ਜੀ ਦੇ ਪਰਿਵਾਰ ਦੇ ਨਾਲ ਮਿਲ ਪਾਉਂਦਾ ਹਾਂ ਪਿੰਡ ਵਿੱਚ ਇੱਦਾਂ ਦੇ ਬਹੁਤ ਸਾਰੇ ਕੰਮ ਹਨ ਜਿਹੜੇ ਮੈਂ ਪਿੰਡ ਵਿੱਚ ਹੀ ਕਰ ਸਕਦਾ ਹਾਂ ਸ਼ਹਿਰ ਵਿੱਚ ਨਹੀਂ ਕਰ ਸਕਦਾ ਜਿਵੇਂ ਕਿ ਸਵੇਰੇ ਸਵੇਰੇ ਉੱਠ ਕੇ ਖੇਤ ਜੋਤਨਾ ਫਿਰ ਫਸਲਾਂ ਨੂੰ ਪਾਣੀ ਦੇਣਾ ਗਾਂਈਆਂ ਦਾ ਦੁੱਧ ਚੋਣਾ ਅਤੇ ਮੱਝਾਂ ਨੂੰ ਨਵ੍ਹਾਉਣਾ ਇੱਦਾਂ ਦੇ ਕੰਮ ਬੰਦਾ ਸ਼ਹਿਰ ਵਿੱਚ ਨਹੀਂ ਕਰ ਸਕਦਾ ਪਰ ਇਹ ਕੰਮ ਬੰਦੇ ਨੂੰ ਪਿੰਡ 'ਚ ਹੀ ਕਰਨ ਨੂੰ ਮਿਲਣਗੇ ਪਿੰਡ ਵਿੱਚ ਬੰਦਾ ਆਪਣੀ ਸਾਰੀ ਥਕਾਨ ਥਕੂਣ ਭੁੱਲ ਕੇ ਮਜ਼ੇ ਨਾਲ ਸ਼ਾਂਤੀ ਨਾਲ ਇੱਕ ਨਵੇਂ ਹੀ ਵਾਤਾਵਰਨ 'ਚ ਰਹਿ ਸਕਦਾ ਹੈ ਪਿੰਡ ਵਿੱਚ ਮੇਰਾ ਸਭ ਤੋਂ ਮਨਪਸੰਦ ਕੰਮ ਮੈਂ ਦੱਸਣਾ ਚਾਹਾਂਗਾ ਉਹ ਹੈ ਜਿਹੜਾ ਚੁੱਲ੍ਹੇ ਉੱਤੇ ਬਣੇ ਦਾ ਰੋਟੀਆਂ ਅਤੇ ਸਾਗ ਵਗੈਰਾ ਦਾ ਸਵਾਦ ਲੈਣਾ ਉਹ ਕੰਮ ਸਭ ਤੋਂ ਵਧੀਆ ਕੰਮ ਹੈ ਮੈਂ ਹੋਰ ਵੀ ਦੱਸਣਾ ਚਾਹਾਂਗਾ ਕਿ ਪਿੰਡ ਵਿੱਚ ਸ਼ਾਮ ਵੇਲੇ ਕ੍ਰਿਕੇਟ ਵਗੈਰਾ ਵੀ ਖੇਡਿਆ ਜਾਂਦਾ ਹੈ ਬਿਲਕੁਲ ਦੇਸੀ ਸਟਾਇਲ ਵਿੱਚ ਸ਼ੁਕਰੀਆ